ਸਤਾਰਾਂ ਨਵੰਬਰ ਉੱਨੀ ਸੌ ਨੱਬੇ ਵੀਹ ਜੁਲਾਈ ਉੱਨੀ ਸੌ ਅਠਾਸੀ ਉਣੱਤੀ ਦਸੰਬਰ ਦੋ ਹਜ਼ਾਰ ਪੰਦਰਾਂ ਉਣੱਤੀ ਨਵੰਬਰ ਉੱਨੀ ਸੌ ਅਠਾਹਠ ਸਤਾਰਾਂ ਅਪ੍ਰੈਲ ਉੱਨੀ ਸੌ ਸਤਾਹਠ